ਪਹਿਲਾਂ ਦੇ ਸਮੇਂ ਵਿੱਚ ਇੰਨੀ ਟੈਕਨੀਕਲੀ ਅਡਵਾਂਸ ਨਹੀਂ ਸੀਗੀ ਤਾਂ ਹੁਣ ਇਸ ਸਮੇਂ ਦੀ ਗੱਲ ਕਰੀ ਜਾਵੇ ਤਾਂ ਟੈਕਨ ਟੈਕਨੋਲੇਜੀ ਬਹੁਤ ਹੀ ਆ ਚੁੱਕੀ ਹੈ ਜਿਵੇਂ ਕਿ ਏ ਆਈ ਏ ਆਈ ਦੀ ਮਦਦ ਨਾਲ ਅਸੀਂ ਰੈਸਟੋਰੈਂਟਾਂ ਵਿੱਚ ਓਡਰ ਆਪਣਾ ਕਰ ਸਕਦੇ ਹਾਂ ਜੋ ਕਿ ਉਹ ਬ ਬਹੁਤ ਹੀ ਵਧੀਆ ਤਰੀਕੇ ਨਾਲ ਓਡਰ ਕਰਦੇ ਨੇ ਹੁਣ ਤਾਂ ਬੰਦਿਆਂ ਨੂੰ ਇੰਨੀ ਕੰਮ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਏ ਆਈ ਦੀ ਬਹੁਤ ਹੀ ਉਹਨਾਂ ਨੂੰ ਸਹਾਇਤਾ ਮਿਲਦੀ ਹੈ ਅਤੇ ਅੱਜ ਕੱਲ੍ਹ ਤਾਂ ਬੰਦਿਆਂ ਨੇ ਆਪਣੇ ਕੰਪਨੀਸ ਦੇ ਵਿੱਚ ਮਸ਼ੀਨਾਂ ਕੋਲ ਰੋਬੋਟ ਵੀ ਲਗਾ ਦਿੱਤੇ ਨੇ ਜੇ ਊਹ ਬੰਦਿਆਂ ਨੂੰ ਤਾਂ ਕੰਮ ਹੀ ਨਹੀਂ ਕਰਨਾ ਪੈਂਦਾ ਕਿਉਂਕਿ ਸਾਰਾ ਹੀ ਕੰਮ ਉਹ ਰੋਬੋਟਸ ਰੋਬੋਟਸ ਦੀ ਸਹਾਇਤਾ ਨਾਲ ਹੀ ਕਰਵਾ ਲੈਂਦੇ ਨੇਗੇ ਅਤੇ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਵਧੀਆ ਟੈਕਨੋਲੇਜੀ ਆ ਰਹੀ ਹੈ